ਸਾਡੇ ਖੇਤਰ ਰਵਾਇਤੀ ਖੇਡਾਂ ਕਈ ਤਰ੍ਹਾਂ ਦੀਆਂ ਖੇਡੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਪਿੱਠੂ ਗੇਮ ਬੜੀ ਮਸ਼ਹੂਰ ਖੇਡ ਸੀ ਜਿਸ ਨੂੰ ਲੋਕ ਹੁਣ ਵੀ ਪਸੰਦ ਕਰਦੇ ਨੇ ਅਤੇ ਖੇਡਦੇ ਨੇ ਜਿਸ ਵਿੱਚ ਅਸੀਂ ਇੱਕ ਕੱਪੜੇ ਦੀ ਗੇਂਦ ਬਣਾ ਲੈਂਦੇ ਸੀ ਅਤੇ ਕੁਝ ਚਿਦੀਆਂ ਇਕੱਠੀਆਂ ਕਰਕੇ ਇੱਕ ਜਗ੍ਹਾ ਲਾ ਲੈਂਦੇ ਸੀ ਅਤੇ ਉਸ ਗੇਂਦ ਨਾਲ ਅਸੀਂ ਉਸ ਚਿਦੀਆਂ ਨੂੰ ਨਿਸ਼ਾਨਾ ਲਾਉਂਦੇ ਸੀ ਅਤੇ ਜਦ ਉਹਨੂੰ ਉਹ ਨਿਸ਼ਾਨਾ ਲਾ ਲੈਂਦੇ ਸੀ ਅਤੇ ਜੇ ਉਹ ਚਿਦੀਆਂ ਗਿਰ ਜਾਂਦੀਆਂ ਸੀ ਅਤੇ ਅਸੀਂ ਇੱਧਰ ਉੱਧਰ ਦੌੜਦੇ ਸੀ ਅਤੇ ਜਿਹੜੀ ਉਹ ਗੇਂਦ ਸੀ ਜਿਸ ਨਾਲ ਅਸੀਂ ਚਿਦਾਂ ਨੂੰ ਨਿਸ਼ਾਨਾ ਲਾਇਆ ਸੀ ਉਹ ਫਿਰ ਅਸੀਂ ਦੂਜੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸੀ ਅਤੇ ਇਸ ਤੋਂ ਇਲਾਵਾ ਸਾਡੇ ਇੱਥੇ ਲੋਕਾਂ ਨੂੰ ਮੇਟੀ ਕ੍ਰਿਕਟ ਫੁਟਬੋਲ ਇਹ ਚੀਜ਼ਾਂ ਵੀ ਕਾਫੀ ਜ਼ਿਆਦਾ ਸਟਾਰਟਿੰਗ ਤੋਂ ਖੇਡੀਆਂ ਜਾਂਦੀਆਂ ਹਨ ਅਤੇ ਪਸੰਦ ਕੀਤੀਆਂ ਜਾਂਦੀਆਂ ਹਨ ਸ਼ਾਮ ਨੂੰ ਬੱਚੇ ਇਕੱਠੇ ਹੋ ਕੇ ਇਹ ਸਾਰੀਆਂ ਗੇਮਾਂ ਖੇਡਦੇ ਹਨ ਅਤੇ ਇੰਜੋਏ ਕਰਦੇ ਨਾ ਅਤੇ ਇਸ ਨਾਲ ਸਾਡੀ ਸਰੀਰ ਦੀ ਫਿਟਨੈਸ ਵੀ ਫਿਜੀਕਲ ਵਰਕ ਵੀ ਹੋ ਜਾਂਦਾ ਹੈ ਅਤੇ ਫਿਟਨੈਸ ਵੀ ਬਣੀ ਰਹਿੰਦੀ ਸੀ ਇਹ ਗੇਮਾਂ ਹੁਣ ਵੀ ਸਾਡੇ ਇੱਥੇ ਚੱਲਦੀਆਂ ਨੇ ਅਤੇ ਲੋਕ ਇਹਨਾਂ ਨੂੰ ਬਹੁਤ ਪਸੰਦ ਕਰਦੇ ਹਨ